ਅੱਜ ਕੱਲ੍ਹ ਦੇ ਜਮਾਨੇ ਵਿੱਚ ਸਾਨੂੰ ਕਿਸੇ ਵੀ ਚੀਜ਼ ਲਈ ਕੋਈ ਔਖ ਨਹੀਂ ਹੁੰਦੀ ਜਿੱਦਾਂ ਕਿ ਸਾਡੇ ਹੀ ਸ਼ਹਿਰ ਪਠਾਨਕੋਟ ਵਿੱਚ ਸਾਨੂੰ ਕਰਿਆਨੇ ਸਬਜ਼ੀਆਂ ਦੀਆਂ ਆਦਿ ਦੁਕਾਨਾਂ ਵੀ ਨੇੜੇ ਹੀ ਮਿਲ ਜਾਂਦੀਆਂ ਹਨ ਹਰ ਗਲੀ ਨੁੱਕੜ ਮੋੜ 'ਤੇ ਤੁਹਾਨੂੰ ਕੋਈ ਨਾ ਕੋਈ ਛੋਟੀ ਦੁਕਾਨ ਮਿਲ ਜਾਂਦੀ ਹੈ ਜਿਸ ਵਿੱਚੋਂ ਤੁਸੀਂ ਆਪਣੀ ਜ਼ਰੂਰਤ ਦਾ ਸਮਾਨ ਲੈ ਸਕਦੇ ਹੋ ਇੰਨਾ ਹੀ ਨਹੀਂ ਦੁਕਾਨਾਂ ਦੇ ਨਾਲ ਨਾਲ ਅੱਜ ਕੱਲ੍ਹ ਮੋਲਸ ਵਿੱਚ ਵੀ ਸਬਜ਼ੀਆਂ ਵਗੈਰਾ ਦਾ ਇੱਕ ਵੱਖਰਾ ਪਾਸਾ ਬਣਾ ਦਿੱਤਾ ਹੁੰਦਾ ਹੈ ਜਿਸ ਨਾਲ ਅਸੀਂ ਆਪਣਾ ਸੁੱਕਾ ਰਾਸ਼ਨ ਜਾਂ ਫਿਰ ਸਬਜ਼ੀਆਂ ਵਗੈਰਾ ਉਥੋਂ ਵੀ ਖਰੀਦ ਸਕਦੇ ਹਾਂ ਇਸ ਲਈ ਇਸ ਲਈ ਕਿਸੇ ਨੂੰ ਵੀ ਕੋਈ ਔਖ ਨਹੀਂ ਹੁੰਦੀ ਅੱਜ ਕੱਲ੍ਹ ਤਾਂ ਇਹ ਸਭ ਔਨਲਾਈਨ ਵੀ ਮੰਗਵਾਇਆ ਜਾ ਸਕਦਾ ਹੈ ਜਿੱਦਾਂ ਕਿ ਬਲਿੰਕਿਟ ਨਾਮ ਦੀ ਇੱਕ ਵੈੱਬਸਾਈਟ ਤੋਂ ਸਾਡਾ ਸਮਾਨ ਜਲਦ ਤੋਂ ਜਲਦ ਆ ਜਾਂਦਾ ਹੈ ਜਿਸ ਨਾਲ ਅਸੀਂ ਆਪਣੇ ਸਬਜ਼ੀਆਂ ਵੀ ਮੰਗਵਾ ਸਕਦੇ ਹਾਂ ਹੋਰ ਵੀ ਅਜਿਹੇ ਕਹੇ ਐਪ ਹਨ ਜਿਸ ਤੋਂ ਅਸੀਂ ਔਨਲਾਈਨ ਖਰੀਦਦਾਰੀ ਕਰ ਸਕਦੇ ਹਾਂ ਚਾਹੇ ਫਿਰ ਉਹ ਘਰ ਦਾ ਸਮਾਨ ਹੋ ਜਾਂ ਖਾਣ ਪੀਣ ਦੀਆਂ ਚੀਜ਼ਾਂ ਪਰ ਮੇਰੇ ਹਿਸਾਬ ਨਾਲ ਇਹ ਇੰਨੀ ਚੰਗੀਆਂ ਨਹੀਂ ਹੁੰਦੀਆਂ ਕਿਉਂਕਿ ਜੋ ਤਾਜ਼ੀ ਸਬਜ਼ੀ ਹੈ ਉਹ ਤਾਂ ਤਾਜ਼ੀ ਹੀ ਹੁੰਦੀ ਹੈ